ਯੋਗਾ ਬਾਰੇ ਮੈਂ ਆਪਣੇ ਵਿਚਾਰ ਇਸ ਤਰ੍ਹਾਂ ਦੱਸ ਸਕਦਾ ਹਾਂ ਕਿਉਂਕਿ ਮੈਂ ਬਹੁਤ ਪੁਰਾਣੇ ਟਾਈਮ ਤੋਂ ਯੋਗਾ ਦੇ ਨਾਲ ਜੁੜਿਆ ਹੋਇਆ ਹਾਂ ਔਰ ਮੈਨੂੰ ਯੋਗਾ ਕਰਨ ਦਾ ਬਹੁਤ ਸ਼ੌਂਕ ਵੀ ਹੈ ਜਿਸ ਕਾਰਨ ਅਨੇਕਾਂ ਹੀ ਇਸ ਦੇ ਫਾਇਦੇ ਹਨ ਮਾਨਸਿਕ ਸੰਤੁਲਨ ਬਣਿਆ ਰਹਿੰਦਾ ਹੈ ਸਰੀਰਕ ਤੰਦਰੁਸਤੀ ਰਹਿੰਦੀ ਹੈ ਅੱਖਾਂ ਦੀ ਰੋਸ਼ਨੀ ਜਿਹੜੀ ਆ ਉਹ ਠੀਕ ਰਹਿੰਦੀ ਹੈ ਤੁਸੀਂ ਕਿਸੇ ਤਰ੍ਹਾਂ ਦੀ ਵੀ ਮਾਨਸਿਕਤਾ ਦੇ ਸ਼ਿਕਾਰ ਨਹੀਂ ਹੁੰਦੇ ਕਿਉਂਕਿ ਜਦੋਂ ਅਸੀਂ ਯੋਗਾ ਸ ਕਰਦੇ ਹਾਂ ਪਰਾਣਾਯਾਮ ਕਰਦੇ ਹਾਂ ਲੋਂਗ ਵਲੋਂਗ ਕਰਦੇ ਹਾਂ ਉਹਦੇ ਨਾਲ ਸਾਡਾ ਸਰੀਰ ਪਿਓਰੀਫਾਈ ਹੁੰਦਾ ਹੈ ਉਹਦੇ ਪਿਉਰੀਫਾਈ ਹੋਣ ਦੇ ਨਾਲ ਨਾਲ ਸਰੀਰ ਸਾਡੇ 'ਚ ਤੰਦਰੁਸਤੀ ਆਉਂਦੀ ਆ ਸਫੁਰਤੀ ਆਉਂਦੀ ਆ ਤਾਂ ਕਿ ਮਾਨਸਿਕਤਾ ਜਿਹੜੀ ਸਾਡੀ ਉਹ ਦੂਰ ਹੁੰਦੀ ਹੈ ਔਰ ਸਾਡਾ ਡਿਪਰੈਸ਼ਨ ਤੱਕ ਵੀ ਦੂਰ ਹੁੰਦਾ ਮੈਂ ਇਹ ਖੁਦ ਆਪਣੇ ਆਪ 'ਤੇ ਮਹਿਸੂਸ ਕੀਤਾ ਹੈ ਇਹ ਦੇਖਿਆ ਜਾਂਦਾ ਹੈ ਕਿ ਸਰੀਰ ਦੇ ਲਈ ਯੋਗਾ ਜਿਹੜੇ ਅਸੀਂ ਕਰਦੇ ਹਾਂ ਇਹਦੇ ਨਾਲ ਤਬਦੀਲੀਆਂ ਕਿਆ ਆ ਸਕਦੀਆਂ ਨੇ ਤਬਦੀਲੀਆਂ ਜਦ ਕਿ ਜਦਕਿ ਗੁਟਨੇ ਦੀ ਪ੍ਰੋਬਲਮ ਦੂਰ ਹੁੰਦੀ ਆ ਜਿਹੜੀ ਕਿ ਮੈਂ ਖੁਦ ਦੇਖੀ ਆ ਅੱਜ ਤੱਕਰ ਸੱਤਰ ਸਾਲ ਦਾ ਮੈਂ ਸਵੇਰੇ ਸੈਰ ਨੀਅਰ ਅਬਾਊਟ ਅੱਠ ਕਿਲੋਮੀਟਰ ਦੇ ਕਰੀਬ ਰੋਜ਼ ਕਰਦਾ ਹਾਂ ਔਰ ਸੂਰਿਆ ਨਮਸਕਾਰ ਕਰਨ ਨਾਲ ਤੁਹਾਡੀ ਰੀੜ੍ਹ ਦੀ ਹੱਡੀ ਠੀਕ ਰਹਿੰਦੀ ਹੈ ਅਰਧ ਆਸਨ ਕਰਨ ਨਾਲ ਤੁਹਾਡਾ ਸਰੀਰ ਚੁਸਤ ਫੁਰਤ ਰਹਿੰਦਾ ਹੈ ਔਰ ਸਿਰ ਥੱਲੇ ਲੱਤਾਂ ਉੱਪਰ ਕਰਨ ਨਾਲ ਤੁਹਾਡਾ ਖੂਨ ਦਾ ਸੰਚਾਰ ਬਹੁਤ ਤੇਜ਼ੀ ਨਾਲ ਵੱਧਦਾ ਹੈ ਜਿਹਦੇ ਨਾਲ ਕਿ ਤੁਹਾਡਾ ਜੋ ਕੋਈ ਵੀ ਮਾਨਸਿਕਤਾ ਦਾ ਤੁਸੀਂ ਸ਼ਿਕਾਰ ਨਹੀਂ ਹੁੰਦੇ ਜੋ ਮੈਂ ਖੁਦ ਮਹਿਸੂਸ ਕੀਤਾ ਇਸ ਲਈ ਯੋਗਾ ਹਰ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਦੂਰ ਕਰਦਾ ਹੈ ਔਰ ਮੈਂ ਤਾਂ ਇਹ ਮਹਿਸੂਸ ਕਰਦਾ ਹਰ ਇੱਕ ਇਨਸਾਨ ਨੂੰ ਜਿਹੜੀ ਛੋਟੀ ਉਮਰ ਤੋਂ ਹੀ ਇਹ ਯੋਗਾ ਸ ਕਰਨਾ ਚਾਹੀਦਾ ਤਾਂ ਕਿ ਸਾਨੂੰ ਜ ਅਸੀਂ ਬਿਮਾਰੀਆਂ ਦੇ ਸ਼ਿਕਾਰ ਤੋਂ ਬਚ ਸਕੀਏ ਔਰ ਸਾਡੀ ਜਿਹੜੀਆਂ ਬਿਮਾਰੀਆਂ ਉਹ ਦੂਰ ਹੋ ਸਕਣ ਇਸ ਲਈ ਯੋਗਾ ਸਾਡੇ ਸਰੀਰ ਲਈ ਬਹੁਤ ਹੀ ਜ਼ਰੂਰੀ ਹੈ ਜਿਸ ਤਰ੍ਹਾਂ ਕਿ ਮੈਂ ਅੱਜ ਤੀਕਰ ਦੇਖਿਆ ਆ ਔਰ ਮਹਿਸੂਸ ਕੀਤਾ ਹੈ ਸਰੀਰ ਵਾਸਤੇ ਪਰ ਪ੍ਰਾਥਮਿਕਤਾ ਦੇਣੀ ਚਾਹੀਦੀ ਆ ਜੇ ਸਰੀਰ ਤੰਦਰੁਸਤ ਆ ਤਾਂ ਅਸੀਂ ਤੰਦਰੁਸਤ ਰਹਾਂਗੇ